ਹਜੇ ਤੱਕ ਤਾਂ ਇਸ ਤਰ੍ਹਾਂ ਦਾ ਕੋਈ ਵੀ ਗ੍ਰਹਿ ਨਹੀਂ ਹੈ ਕਿ ਜਿੱਥੇ ਜੀਵਨ ਬਿਤਾਉਣਾ ਸੌਖਾ ਹੋਵੇ ਪਰ ਸਾਡੇ ਸਾਇੰਟਿਸਟ ਖੋਜ ਕਰਿਆ ਕਰਦੇ ਹੈ ਮਾਰਸ ਤੇ ਉੱਤੇ ਮਾਰਸ ਉੱਤੇ ਬੀਸ ਪਰਸੈਂਟ ਚਾਂਸਿਸ ਹੈ ਕਿ ਉੱਥੇ ਵੀਹ ਪਰਸੈਂਟ ਚਾਂਸ ਹੈ ਲਾਈਫ ਜਿਵੇਂ ਕਿ ਇਨਸਾਨ ਆਪਣਾ ਜੀਵਨ ਬਤੀਤ ਕਰ ਸਕਦਾ ਆ ਉੱਥੇ ਉਹ ਹਜੇ ਖੋਜ ਕਰਿਆ ਕਰਦੇ ਆ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਾਡੀ ਧਰਤੀ ਉੱਤੇ ਪਾਣੀ ਦੀ ਵੀ ਸਾਨੂੰ ਫੈਸਿਲਿਟੀਜ ਹੈ ਖਾਣਾ ਰਹਿਣਾ ਸਾਨੂੰ ਆਕਸੀਜਨ ਸਭ ਕੁਛ ਮਿਲਿਆ ਕਰਦਾ ਹੈ ਅਤੇ ਇੱਥੇ ਰਹਿਣਾ ਇੱਥੇ ਜੀਵਨ ਬਤੀਤ ਕਰਨਾ ਇਹ ਇੱਕ ਬਹੁਤ ਅੱਛੀ ਗੱਲ ਹੈ ਔਰ ਗ੍ਰਹਿਵਾਂ 'ਤੇ ਸਾਨੂੰ ਇਹ ਕੁਛ ਹਜੇ ਤੱਕ ਨਹੀਂ ਮਿਲ ਸਕਿਆ ਹੈ ਕਿ ਅਸੀਂ ਔਰ ਗ੍ਰਹਿ 'ਤੇ ਜਾ ਕੇ ਰਹਿ ਸਕੀਏ ਮਾਰਸ 'ਤੇ ਇੱਕ ਸਿਰਫ਼ ਟਵੇਂਟੀ ਪਰਸੈਂਟ ਸਾਨੂੰ ਚਾਂਸ ਹੈ ਪਰ ਉਹ ਵੀ ਹਜੇ ਸਾਡੇ ਸਾਇੰਟਿਸਟ ਕੋਸ਼ਿਸ਼ ਕਰਿਆ ਕਰਦੇ ਆ ਕਿ ਉੱਥੇ ਔਰ ਵੀ ਉਹ ਖੋਜ ਕਰ ਸਕਣ ਅਤੇ ਇਸ ਤਰ੍ਹਾਂ ਤੇ ਦੇਖਿਆ ਜਾਵੇ ਤਾਂ ਅਸੀਂ ਸਿਰਫ਼ ਇੱਕ ਧਰਤੀ 'ਤੇ ਹੀ ਸਾਨੂੰ ਇਹ ਰਹਿਣ ਦਾ ਚਾਂਸ ਮਿਲਦਾ ਹੈ ਕਿਉਂਕਿ ਇੱਥੇ ਹੀ ਸਾਨੂੰ ਸਭ ਕੁਛ ਜੀਵਨ ਜੀਣ ਵਾਸਤੇ ਜੋ ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਆਕਸੀਜਨ ਚਾਹੀਦੀ ਆ ਖਾਣਾ ਚਾਹੀਦਾ ਪਾਣੀ ਚਾਹੀਦਾ ਹਵਾ ਵਾਯੂ ਜੋ ਵੀ ਸਾਨੂੰ ਚਾਹੀਦੇ ਹਨ ਉਹ ਸਭ ਸਾਨੂੰ ਧਰਤੀ ਉੱਤੇ ਹੀ ਮਿਲਦਾ ਪਿਆ ਹੈ ਜਿਹਨੂੰ ਅਸੀਂ ਇੱਕ ਭਗਵਾਨ ਦਾ ਵਰਦਾਨ ਹੀ ਕਹਿ ਸਕਦੇ ਹਾਂ ਬਾਕੀ ਗ੍ਰਹਿਆਂ 'ਤੇ ਹਲੇ ਤੱਕ ਸਾਨੂੰ ਇਹੋ ਜਿਹਾ ਕੋਈ ਨਹੀਂ ਮਿਲਿਆ ਹੈਗਾ ਚਾਂਸ